ਮੈਂ ਜਦ ਸਕੂਲ 'ਚ ਪੜ੍ਹਦਾ ਸੀਗਾ ਤਾਂ ਮੇਰਾ ਸਭ ਨਾਲੋਂ ਪਸੰਦ ਵਿਸ਼ਾ ਸੀਗਾ ਮਨਪਸੰਦ ਪੰਜਾਬੀ ਜਿਹੜੀ ਸਾਡੀ ਗੁਰੂਆਂ ਨੇ ਬਾਣੀ ਵੀ ਪੰਜਾਬੀ ਦੇ ਵਿੱਚ ਉਚਾਰੀ ਸਾਡੇ ਗੁਰੂ ਗ੍ਰੰਥ ਸਾਹਿਬ ਵੀ ਪੰਜਾਬੀ ਵਿੱਚ ਸਾਨੂੰ ਉੱਥੋਂ ਅਧਿਆਤਮਕ ਤੌਰ 'ਤੇ ਸਾਰੀ ਸ਼ਿਕਸ਼ਾ ਮਿਲਦੀ ਹੈ ਦੂਜਾ ਵਿਸ਼ਾ ਜਿਹੜਾ ਔਖਾ ਸੀਗਾ ਉਹ ਮੈਥ ਗਲਤ ਉਹਦੇ ਵਿੱਚ ਸਾਡੇ ਜਿਹੜੇ ਸਕੂਲ ਦੇ ਮੈਥ ਦੇ ਟੀਚਰ ਸੀ ਉਹ ਰੋਜ਼ ਟੈਸਟ ਲੈਂਦੇ ਹੁੰਦੇ ਸੀਗੇ ਕਦੀ ਕਿਸੇ ਸਵਾਲ ਦਾ ਕਦੀ ਕਿਸੇ ਸਵਾਲ ਦਾ ਇੱਕ ਦਿਨ ਉਹਨਾਂ ਨੇ ਥਿਊਰਮ ਦਾ ਕੁਸਚਨ ਜਿਹੜਾ ਕਨੀ ਉਹ ਕੀਤਾ ਟੈਸਟ ਲਿਆ ਅਤੇ ਉਹਦੇ ਵਿੱਚ ਸਾਰੇ ਬੱਚਿਆਂ ਨੇ ਕੱਢ ਕੇ ਆਪਣੇ ਫੜਾ ਦਿੱਤੇ ਪੇਪਰ ਟੈਸਟ ਦੇ ਇੱਕ ਜਿਹਦਾ ਨਾਂ ਸੀ ਹਰਸ਼ਮਸ਼ੇਰ ਜੰਗ ਬਹਾਦਰ ਸਿੰਘ ਇੱਕ ਲੜਕਾ ਸੀਗਾ ਉਹਦੇ ਕੋਲੋਂ ਉਹਦਾ ਨਹੀਂ ਕੋਈ ਟੈਸਟ ਦਿੱਤਾ ਗਿਆ ਉਹਨੂੰ ਨਹੀਂ ਸੀ ਆਈ ਸਾਡੇ ਸਕੂਲ ਦੇ ਟੀਚਰ ਜਿਹੜੇ ਮੈਥ ਦੇ ਲੈ ਰਹੇ ਟੈਸਟ ਉਹਨਾਂ ਨੇ ਕਿਹਾ ਤੇਰਾ ਬਾਪ ਨੇ ਨਾਂ ਤੇਰਾ ਰੱਖ ਦਿੱਤਾ ਹਰਸ਼ਮਸ਼ੇਰ ਜੰਗ ਬਹਾਦਰ ਸਿੰਘ ਇਹਦਾ ਕੀ ਮਤਲਬ ਹੈ ਇੱਡਾ ਵੱਡਾ ਨਾਂ ਹੈ ਜਿਹਦੇ ਵਿੱਚ ਤੂੰ ਅਸੀਂ ਰਜਿਸਟਰ ਖੋਲ੍ਹਦੇ ਹਾਂ ਜਿੱਥੇ ਪ੍ਰੈਜੈਂਟ ਲਾਉਣੀ ਹੁੰਦੀ ਜਗ੍ਹਾ ਹੀ ਕੋਈ ਨਹੀਂ ਹੁੰਦੀ ਅਤੇ ਉਹ ਸਾਰੀ ਕਲਾਸ ਫਿਰ ਹੱਸ ਪਈ ਅਤੇ ਸਾਡੇ ਮਾਸਟਰ ਸਾਹਿਬ ਦੇ ਜਿਹੜੇ ਸਾਡੇ ਟੀਚਰ ਸੀਗੇ ਗਣਿਤ ਦੇ ਉਹਨਾਂ ਨੇ ਕਿਹਾ ਕਹਿੰਦਾ ਤੇਰੇ ਪਿਉ ਦਾ ਨਾਂ ਡਾਕਟਰ ਗੁਲਾਬ ਸਿੰਘ ਅਤੇ ਤੂੰ ਵੀ ਲਿਖ ਲੈ ਡਾਕਟਰ ਹਰਸ਼ਮਸ਼ੇਰ ਜੰਗ ਬਹਾਦਰ ਸਿੰਘ ਤੂੰ ਵੀ ਇੱਕ ਕਿਰਲੀ ਲੈ ਕੇ ਸ਼ੀਸ਼ੀ 'ਚ ਪਾ ਕੇ ਬਹਿ ਜਾ ਬਾਪ ਤੇਰੇ ਨੇ ਵੀ ਡਾਕਟਰ ਵਿੱਚ ਉਹਦਾ ਇਹ ਅੱਧੀ ਕਿਰਲੀ ਇੱਕ ਦੋ ਕਛੂਏ ਸ਼ੀਸ਼ੀ 'ਚ ਪਾ ਕੇ ਦੁਕਾਨ ਦੇ ਉੱਤੇ ਟੇਬਲ 'ਤੇ ਰੱਖੇ ਹੁੰਦੇ ਨੇ ਅਤੇ ਤੂੰ ਵੀ ਇਸ ਤਰ੍ਹਾਂ ਬਣਾ ਲੈ ਉਹ ਫਿਰ ਕਲਾਸ ਦੇ ਵਿੱਚ ਬਹੁਤਾ ਹਾਸਾ ਪਿਆ ਅਤੇ ਫਿਰ ਟੀਚਰ ਸੀਗੇ ਉਹਨੇ ਉਹਨੇ ਫਿਰ ਸ਼ਾਬਾਸ਼ ਦਿੱਤੀ